ਕਾਫੀ ਸਾਰੇ ਲੋਕਾਂ ਨੂੰ ਜਿਹੜਾ ਕਿ ਅਖ਼ਬਾਰ ਪੜ੍ਹਨਾ ਬਹੁਤ ਹੀ ਪਸੰਦ ਹੈ ਇਹਦੇ ਨਾਲ ਕੀ ਸਾਨੂੰ ਸਾਡੇ ਆਲੇ ਦੁਆਲੇ ਦੀ ਅਤੇ ਸਾਡੇ ਆਲੇ ਦੁਆਲੇ ਦੇ ਦੇਸ਼ਾਂ ਵਿਦੇਸ਼ਾਂ ਅਤੇ ਸਾਡੇ ਰਾ ਆਲੇ ਦੁਆਲੇ ਦੇ ਪਿੰਡਾਂ ਅਤੇ ਸਾਡੇ ਸ਼ਹਿਰਾਂ ਵਿੱਚ ਕੀ ਚੱਲ ਰਿਹਾ ਉਹਦਾ ਪਤਾ ਲੱਗਦਾ ਇਹ ਸਾਨੂੰ ਕਾਫੀ ਤਰੀਕੇ ਦੀਆਂ ਖ਼ਬਰਾਂ ਵੀ ਪ੍ਰਦਾਨ ਕਰਦੇ ਹੈਗੇ ਅਤੇ ਮੈਂ ਅਖ਼ਬਾਰ ਪੜ੍ਹਨਾ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਇਹ ਮੇਰਾ ਰੂਟੀਨ ਹੀ ਬਣ ਗਿਆ ਕਿ ਅਖ਼ਬਾਰ ਪੜ੍ਹਨ ਤੋਂ ਬਿਨਾਂ ਮੈਨੂੰ ਆਪਣਾ ਦਿਨ ਦਿਨ ਹੀ ਨਹੀਂ ਲੱਗਦਾ ਸਵੇਰ ਦੀ ਚਾਹ ਜਦੋਂ ਮੈਂ ਪੀਂਦੀ ਹਾਂ ਤਾਂ ਮੈਂ ਅਖ ਇੱਕ ਅਖ਼ਬਾਰ ਨੂੰ ਪੜ੍ਹਨਾ ਜ਼ਰੂਰ ਹੀ ਪਸੰਦ ਕਰ ਮੈਂ ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰ ਜ਼ਿਆਦਾ ਪੜ੍ਹਨੇ ਪਸੰਦ ਕਰਦੀ ਹਾਂ ਅਤੇ ਇ ਇਹਨਾਂ ਨੂੰ ਜਦੋਂ ਮੈਂ ਅਖ਼ਬਾਰਾਂ ਨੂੰ ਪੜ੍ਹਦੀ ਹਾਂ ਅਤੇ ਮੈਂ ਆਪਣੇ ਆਪ ਪੜ੍ਹਨ ਤੋਂ ਬਾਅਦ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਪੜ੍ਹਾਉਂਦੀ ਹਾਂ ਇਹਦੇ ਬਾਰੇ ਪ੍ਰੇਰਨਾ ਮੈਨੂੰ ਅਖ਼ਬਾਰ ਪੜ੍ਹਨ ਵਾਲੇ ਪ੍ਰੇਰਨਾ ਮੇਰੇ ਅਧਿਆਪਕ ਨੇ ਦਿੱਤੀ ਸੀ ਉਹ ਵੀ ਅਖ਼ਬਾਰ ਪੜ੍ਹਿਆ ਕਰਦੇ ਸੀ ਅਤੇ ਇਸ ਕਰਕੇ ਮੇਰੀ ਵੀ ਇਸ ਤਰ੍ਹਾਂ ਹੀ ਰੋਜ਼ ਦੀ ਰੂਟੀਨ ਬਣ ਗਈ ਅਖ਼ਬਾਰ ਪੜ੍ਹਨ ਵਾਲੀ ਅਤੇ ਇਹ ਪੜ੍ਹਦੇ ਪੜ੍ਹਦੇ ਕੀ ਮੈਨੂੰ ਬਹੁਤ ਹੀ ਵਧੀਆ ਲੱਗਣ ਲੱਗ ਗਿਆ ਕਿਉਂਕਿ ਮੈਨੂੰ ਸਾਰੇ ਪਾਸੇ ਦੀ ਜਾਣਕਾਰੀ ਅਖ਼ਬਾਰ ਤੋਂ ਹੀ ਪ੍ਰਾਪਤ ਹੋ ਜਾਂਦੀ ਸੀਗੀ ਇਹ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਅਖ਼ਬਾਰ ਪੜ੍ਹਨ ਲਈ ਕੀ ਹੈ ਜਿਹੜਾ ਉਤਸ਼ਾਹਿਤ ਕੀਤਾ ਸੀਗਾ ਅਤੇ ਅਖ਼ਬਾਰ ਪੜ੍ਹਨ ਦੇ ਨਾਲ ਨਾਲ ਉਹਨਾਂ ਦੀਆਂ ਕਾਫੀ ਵਿਆਕਰਨਾਂ ਦੀ ਜਿਹੜੀਆਂ ਗਲਤੀਆਂ ਸੀਗੀਆ ਉਹ ਕਾਫੀ ਸਹੀ ਵੀ ਹੋ ਗਈਆਂ ਅਤੇ ਉਹਨਾਂ ਨੂੰ ਅੰਗਰੇਜ਼ੀ ਪੜ੍ਹਨ ਵਿੱਚ ਵੀ ਕਾਫੀ ਸਹਾਇਤਾ ਮਿਲੀ ਅਤੇ ਉਹਨਾਂ ਨੇ ਕਾਫੀ ਅੰਗਰੇਜ਼ੀ ਨੂੰ ਵੀ ਪੜ੍ਹਿਆ ਅਤੇ ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਜੋ ਮੈਂ ਇਹ ਸਿੱਖਦੀ ਹਾਂ ਕਿ ਮੇਰੇ ਛੋਟੇ ਭੈਣ ਭਰਾ ਵੀ ਸਿੱਖਣ ਅਤੇ ਮੈਨੂੰ ਪੜ੍ਹਨਾ ਬਹੁਤ ਹੀ ਜ਼ਿਆਦਾ ਵਧੀਆ ਵੀ ਲੱਗਦਾ